ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਸਨ ਗੁਰੂ ਨਾਨਕ ਸਾਹਿਬ ਦਾ ਜਨਮ ਪੰਦਰ੍ਹਾਂ ਅਪ੍ਰੈਲ ਚੌਦ੍ਹਾਂ ਸੌ ਉਣਹੱਤਰ ਨੂੰ ਤਲਵੰਡੀ ਰਾਏ ਭੋਏ ਵਿੱਚ ਹੋਇਆ ਇਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਆਖਦੇ ਹਨ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਇਹਨਾਂ ਨੇ ਇੱਕ ਵਾਰ ਵੀਹ ਰੁਪਏ ਦਾ ਸੱਚਾ ਸੌਦਾ ਕੀਤਾ ਇਹਨਾਂ ਦੇ ਦੋ ਪੁੱਤਰ ਸਨ ਭਾਈ ਲਖਮੀ ਦਾਸ ਅਤੇ ਭਾਈ ਸ਼੍ਰੀ ਚੰਦ ਇਹਨਾਂ ਦਾ ਵਿਆਹ ਸੁਲੱਖਣੀ ਦੇਵੀ ਨਾਲ ਹੋਇਆ ਇਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਇਹਨਾਂ ਨੇ ਸਾਰੇ ਸੰਸਾਰ ਨੂੰ ਤਿੰਨ ਗੱਲਾਂ ਸਿਖਾਈਆਂ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹਨਾਂ ਦੀ ਭੈਣ ਦਾ ਨਾਮ ਬੇਬੇ ਨਾਨਕੀ ਸੀ ਅਤੇ ਇਹਨਾਂ ਦੇ ਜੀਜਾ ਜੀ ਦਾ ਨਾਮ ਜੈ ਰਾਮ ਸੀ ਇਹਨਾਂ ਦੇ ਦੋ ਚੇਲੇ ਸਨ ਭਾਈ ਬਾਲਾ ਅਤੇ ਮਰਦਾਨਾ ਇਹਨਾਂ ਨੇ ਆਪਣੀ ਗੁਰਗੱਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਅਤੇ ਇਹ ਸੰਨ ਬਾਈ ਸਤੰਬਰ ਪੰਦਰ੍ਹਾਂ ਸੌ ਉਨਤਾਲੀ ਵਿੱਚ ਜੋਤੀ ਜੋਤ ਸਮਾ ਗਏ ਧੰਨਵਾਦ